ਹਾਂ ਮੇਰੇ ਕੋਲ ਫੋਟੋਗ੍ਰਾਫੀ ਦੀ ਰਸਮੀ ਸਿਖਲਾਈ ਸੀ ਮੈਂ ਆਪਣੇ ਫੋਟੋਗਰਾਫ ਉਹਨਾਂ ਨੂੰ ਸੁਧਾਰਨ ਲਈ ਹਰ ਰੋਜ਼ ਨਵੀਂ ਤੋਂ ਨਵੀਂ ਫੋਟੋ ਵੀਡੀਓ ਸ਼ੂਟ ਕਰਦਾ ਹਾਂ ਉਹਦੇ ਵਿੱਚ ਕੋਈ ਨਾ ਕੋਈ ਕਮੀ ਆਉਂਦੀ ਹੈ ਜਾਂ ਕਮੀ ਕਿਸੇ ਹੋਰ ਨੂੰ ਵੀ ਨਜ਼ਰ ਆਉਂਦੀ ਹੈ ਤਾਂ ਮੈਂ ਉਹ ਆਪਣੀ ਕਮੀ ਜ਼ਰੂਰ ਦੇਖਦਾ ਵੀ ਇਸ ਕਮੀ ਵਿੱਚ ਮੇਰੀ ਕੀ ਫੋਟੋ ਕੀ ਰਹਿ ਗਈ ਕੀ ਫੋਟੋ ਨਹੀਂ ਖਿੱਚੀ ਕੋਈ ਇੱਕ ਐਂਗਲ ਤੋਂ ਜਾਂ ਦੂਸਰੇ ਐਂਗਲ ਤੋਂ ਕੋਈ ਫੋਟੋ ਕਲਿੱਕ ਨਹੀਂ ਹੋਈ ਇਸ ਵਿੱਚ ਆਪਣੀ ਮੈਂ ਕਮੀ ਦੇਖਦਾ ਜਿਸ ਨਾਲ ਮੈਂ ਆਪਣੇ ਇਸ ਫੋਟੋਗ੍ਰਾਫਰ ਦੇ ਕਰੀਅਰ ਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰਦਾ ਮੇਰੀ ਪ੍ਰੇਰਨਾ ਮੇਰੇ ਯਾਰ ਦੋਸਤ ਤੋਂ ਮਿਲੀ ਹੈ ਜੋ ਕਿ ਇੱਕ ਵਧੀਆ ਫੋਟੋਗ੍ਰਾਫਰ ਸੀ ਹੁਣ ਵੀ ਹੈ ਉਹ ਮੈਨੂੰ ਦੱਸਦਾ ਸੀ ਕਿ ਇੱਕ ਵਧੀਆ ਫੋਟੋਗ੍ਰਾਫਰ ਬਣਨ ਲਈ ਸਭ ਤੋਂ ਪਹਿਲਾਂ ਇੱਕ ਵਧੀਆ ਜਿਹਾ ਐਂਗਲ ਜਾਂ ਕਿਸੇ ਐਸੀ ਜਗ੍ਹਾ 'ਤੇ ਜਾ ਕੇ ਫੋਟੋ ਸ਼ੂਟ ਕਰਨੀ ਜਿੱਥੋਂ ਦਾ ਮਾਹੌਲ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ ਸ਼ੋਰ ਸ਼ਰਾਬੇ ਵਾਲਾ ਜਾਂ ਕਿਸੇ ਵੀ ਤਰ੍ਹਾਂ ਦਾ